ਨਵੇਂ ਜਨਮੇ ਬੱਚਿਆਂ ਨੂੰ ਇੱਕ ਸਵੱਛ ਵਾਤਾਵਰਨ ਦੇਣ ਦੇ ਲਈ ਅਸੀਂ ਬਹੁਤ ਅਜਿਹੀਆਂ ਸਹੂਲਤਾਂ ਦੀ ਸਹਾਇਤਾ ਲੈ ਸਕਦੇ ਹਾਂ ਜਿਵੇਂ ਜੇਕਰ ਕੋਈ ਉਸ ਛੋਟੇ ਬੱਚੇ ਨੂੰ ਮਿਲਣ ਲਈ ਆਉਂਦਾ ਹੈ ਤਾਂ ਅਸੀਂ ਉਸਨੂੰ ਕਹਿ ਸਕਦੇ ਹਾਂ ਕਿ ਉਹ ਬੱਚੇ ਨੂੰ ਹੱਥ ਸਾਫ਼ ਕਰਕੇ ਸੈਨੀਟਾਈਜ਼ਰ ਲਗਾ ਕੇ ਉਸ ਬੱਚੇ ਨੂੰ ਹੱਥ ਲਗਾਵੇ ਤਾਂ ਜੋ ਉਸ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਣ ਤੋਂ ਬਚਾਇਆ ਜਾ ਸਕੇ ਇਸ ਤੋਂ ਇਲਾਵਾ ਅਸੀਂ ਬੱਚੇ ਦੇ ਨੂੰ ਬੱਚੇ ਦੇ ਆਲੇ ਦੁਆਲੇ ਮੱਛਰਦਾਨੀ ਰੱਖ ਸਕਦੇ ਹਾਂ ਤਾਂ ਜੋ ਉਸਨੂੰ ਮੱਛਰ ਨਾ ਕੱਟ ਸਕਣ ਜਿਸ ਨਾਲ ਮਲੇਰੀਆ ਜਿਹੀ ਬਿਮਾਰੀਆਂ ਤੋਂ ਬਚਾਉ ਹੋ ਸਕਦਾ ਹੈ